ਜੀ ਹਾਂ ਮੈਂ ਇੱਕ ਕਾਵਿ ਲਿਖਿਆ ਸੀ ਜੋ ਕੀ ਮੇਰੀ ਸਹੇਲੀ ਉੱਤੇ ਸੀ ਮੈਂ ਉਸਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੈਂ ਉਸਦੀ ਅੱਖਾਂ ਬਾਰੇ ਪਹਿਲੀ ਲੈਨ ਲਿਖੀ ਸੀ ਕਿ ਉਸਦੀ ਅੱਖਾਂ ਬਹੁਤ ਮੋਟੀ ਮੋਟੀ ਸੀ ਅਤੇ ਉਸਨੂੰ ਉਹ ਲੈਨ ਵੀ ਬਹੁਤ ਪਸੰਦ ਆਈ ਸੀ ਫਿਰ ਮੈਂ ਉਸਦੇ ਵਾਲਾਂ ਬਾਰੇ ਲਿਖਿਆ ਸੀ ਉਸਦੇ ਵਾਲ ਸੁਨਹਿਰੇ ਰੰਗ ਦੇ ਸੀ ਉਹ ਵੀ ਬਹੁਤ ਅੱਛੇ ਸੀ ਅਤੇ ਮੈਨੂੰ ਬਹੁਤ ਆਕਰਸ਼ਿਤ ਕਰਦੇ ਸੀ ਫਿਰ ਮੈਂ ਉਸਦੇ ਬੁੱਲਾਂ ਬਾਰੇ ਲਿਖਿਆ ਸੀ ਉਸਦੇ ਬੁੱਲ ਬਹੁਤ ਹੀ ਅੱਛੇ ਸੀ ਅਤੇ ਗੁਲਾਬੀ ਰੰਗ ਸੀ ਉਸਨੂੰ ਲਿਪਸਟਿਕ ਦੀ ਵੀ ਜ਼ਰੂਰਤ ਨਹੀਂ ਪੈਂਦੀ ਸੀ ਓਵਰਆਲ ਉਹ ਸਾਰੀ ਹੀ ਬਹੁਤ ਹੀ ਸੋਹਣੀ ਹੀ ਸੀ ਅਤੇ ਮੈਂ ਉਸ ਬ ਪੂਰੇ ਕਾਵਿ ਵਿੱਚ ਉਸਦੇ ਬਾਰੇ ਪੂਰਾ ਲਿਖਿਆ ਸੀ ਅਤੇ ਉਸਨੂੰ ਉਹ ਬਹੁਤ ਪਸੰਦ ਆਇਆ ਸੀ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ